ਹਾਂ ਮੈਂ ਉਸ ਯਾਦਗਾਰੀ ਅਨੁਭਵ ਦਾ ਵਰਣਨ ਕਰ ਸਕਦੀ ਹਾਂ ਜਿਹੜਾ ਕਿ ਮੈਂ ਜਨਤਕ ਤੌਰ 'ਤੇ ਚਿੱਤਰਕਾਰ ਦੀ ਕਰਦੇ ਸਮੇਂ ਜਾਂ ਆਪਣੇ ਕੰਮ ਦੀ ਪ੍ਰਦਰਸ਼ਨੀ ਕਰਦੇ ਸਮੇਂ ਕੀਤਾ ਹੈ ਮੈਂ ਦਸੰਬਰ ਦੀਆਂ ਛੁੱਟੀਆਂ ਵਿੱਚ ਆਪਣੇ ਪੇਰੈਂਟਸ ਨਾਲ ਮਨਾਲੀ ਘੁੰਮਣ ਗਈ ਸੀ ਅਤੇ ਉੱਥੇ ਮੈਂ ਮੇਰੀ ਮੰਮੀ ਪਾਪਾ ਅਤੇ ਮੇਰਾ ਭਰਾ ਵੀ ਸਨ ਅਤੇ ਫਿਰ ਉੱਥੇ ਅਸੀਂ ਇੱਕ ਗਾਰਡਨ ਦੇ ਵਿੱਚ ਸਨ ਅਤੇ ਉੱਥੇ ਪਿਛਲੇ ਪਿਛਲੇ ਪਾਸੇ ਜੋ ਵਿਊ ਬੱਦਲ ਬਰਫ ਅਤੇ ਪਿੱਛੇ ਪਹਾੜ ਵਾਲਾ ਜੋ ਵਿਊ ਸੀ ਉਸ ਨੂੰ ਦੇਖ ਕੇ ਮੈਂ ਆਪਣੀ ਚਿੱਤਰਕਾਰੀ ਸ਼ੁਰੂ ਕੀਤੀ ਸੀ ਉਸ 'ਤੇ ਵਿਊ ਉਹ ਅਸੀਂ ਵਿਊ ਲੈ ਕੇ ਮੈਂ ਇੱਕ ਆਪਣੀ ਯਾ ਮੇਰੇ ਲਈ ਇੱਕ ਬਹੁਤ ਯਾਦਗਾਰੀ ਮੂਮੈਂਟ ਬਣ ਚੁੱਕਾ ਸੀ ਅਤੇ ਉੱਥੇ ਆਸ ਪਾਸ ਬਹੁਤ ਹੀ ਸੋਹਣੀਆਂ ਸੋਹਣੀਆਂ ਸਟਾਲਾਂ ਲੱਗੀਆਂ ਹੋਈਆਂ ਸਨ ਆਸ ਪਾਸ ਬਹੁਤ ਹੀ ਸੁੰਦਰ ਵਿਊ ਮੇਰੇ ਲਈ ਇੱਕ ਬਹੁਤ ਹੀ ਯਾਦਗਾਰ ਬਣ ਚੁੱਕਾ ਹੈ ਫਿਰ ਆਸ ਪਾਸ ਦਰਖਤ ਕਈ ਤਰ੍ਹਾਂ ਦੀ ਦੇ ਫਲ ਕਿਸਮ ਦੇ ਪੌਦੇ ਫਿਰ ਇਸ ਤੋਂ ਮੈਨੂੰ ਕੁਦਰਤ ਨਾਲ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਆਸ ਪਾਸ ਬਹੁਤ ਵਧੀਆ ਖੁੱਲ੍ਹੀ ਹਵਾ ਆਕਸੀਜਨ ਅਤੇ ਬਹੁਤ ਹੀ ਵਧੀਆ ਵਿਊ ਸੀ ਅਤੇ ਇਸ ਸਮੇਂ ਮੈਂ ਚਿੱਤਰਕਾਰੀ ਸਾਹਮਣੇ ਉਹਨਾਂ ਦੇ ਪਿਛਲੇ ਪਾਸੇ ਜੋ ਵਿਊ ਸੀ ਪਹਾੜ ਬਰਫ ਸਾਰੀ ਚਿੱਤਰਕਾਰੀ ਨੂੰ ਮੈਂ ਆਪਣੇ ਸਾਹਮਣੇ ਲਿਖਿਆ ਉਸ ਦਿਨ ਮੈਂ ਪਹਿਲੀ ਵਾਰ ਚਿੱਤਰਕਾਰੀ ਕੀਤੀ ਆਪਣੇ ਮੰਮੀ ਪਾਪਾ ਅਤੇ ਪਿਛਲਾ ਵਿਊ ਪਹਾੜਾਂ ਸਨੋ ਬਰਫ ਦਾ ਅਤੇ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ ਅਤੇ ਪਹਿਲੀ ਸੀ ਮੇਰੀ ਪੇਂਟਿੰਗ ਉਹ ਤਾਂ ਬਹੁਤ ਹੀ ਸੋਹਣੀ ਬਣੀ ਅਤੇ ਮੇਰੇ ਦਿਲ ਨੂੰ ਬਹੁਤ ਹੀ ਖੁਸ਼ੀ ਹੋਈ ਅਤੇ ਕਿਉਂਕਿ ਪੇਂਟਿੰਗ ਮੇਰੇ ਮੰਮੀ ਪਾਪਾ ਦੀ ਸੀ ਅਤੇ ਪਹਿਲੀ ਵਾਰ ਮੈਂ ਮੇਰੇ ਕੋਲੋਂ ਇੰਨੀ ਵਧੀਆ ਚਿੱਤਰਕਾਰੀ ਹੋਈ ਅਤੇ ਇਹ ਇਸ ਦਾ ਅਨੁਭਵ ਮੇਰੇ ਲਈ ਬਹੁਤ ਹੀ ਜ਼ਿਆਦਾ ਯਾਦਗਾਰੀ ਸਿੱਧ ਹੋਇਆ ਹੈ ਅਤੇ ਇਸ ਲਈ ਮੈਂ ਆਪਦੇ ਕੰਮ ਦੀ ਪ੍ਰਦਰਸ਼ਨੀ ਬਹੁਤ ਜ਼ਿਆਦਾ ਵਧੀਆ ਕਰ ਸਕਦੀ ਹਾਂ ਇਸ ਇਹ ਪੇਂਟਿੰਗ ਮੇਰੇ ਲਈ ਇੱਕ ਯਾਦ ਬਣ ਗਈ ਹੈ ਅੱਜ ਵੀ ਮੈਂ ਜਦੋਂ ਪੇਂਟਿੰਗ ਨੂੰ ਦੇਖਦੀ ਹਾਂ ਤਾਂ ਮੈਨੂੰ ਉੱਥੋਂ ਦਾ ਉੱਥੋਂ ਬਿਤਾਏ ਹੋਏ ਦਿਨ ਮਨਾਲੀ ਅਸੀਂ ਘੁੰਮੇ ਉਹ ਸਾਰਾ ਵਿਊ ਉਹ ਅੱਜ ਵੀ ਮੈਨੂੰ ਬਹੁਤ ਵਧੀਆ ਯਾਦ ਆਉਂਦਾ ਹੈ